ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਹੀ ਸਥਾਨ ਐਵੇਂ ਦੇ ਹਨ ਜਿੱਥੇ ਬਹੁਤ ਦੂਰ ਦੂਰ ਤੋਂ ਸੈਲਾਨੀ ਘੁੰਮਣ ਲਈ ਆਉਂਦੇ ਹਨ ਅਤੇ ਇਹ ਉਹਨਾਂ ਦਾ ਆਕਰਸ਼ਣ ਦਾ ਇੱਕ ਮੁੱਖ ਕੇਂਦਰ ਬਣਦੇ ਹਨ ਜਿਵੇਂ ਚਿ ਛੱਤਬੀੜ੍ਹ ਚਿੜੀਆ ਘਰ ਜਿੱਥੇ ਬਹੁਤ ਪ੍ਰਕਾਰ ਦੇ ਪੰਛੀ ਜਾਨਵਰ ਪਾਏ ਜਾਂਦੇ ਹਨ ਵੀ ਆਰ ਪੰਜਾਬ ਮੋਲ ਜਿੱਥੇ ਬਹੁਤ ਦੂਰ ਦੂਰ ਤੋਂ ਲੋਕ ਫਿਲਮਾਂ ਦੇਖਣ ਸਮਾਨ ਖਰੀਦਣ ਆਉਂਦੇ ਹਨ ਇਸਦੇ ਨਾਲ ਹੀ ਥ੍ਰੀ ਬੀ ਟੂ ਵੀ ਇੱਕ ਘੁੰਮਣ ਦਾ ਇੱਕ ਖਾਸ ਕੇਂਦਰ ਬਣ ਗਿਆ ਹੈ ਇਸ ਤਰ੍ਹਾਂ ਹੀ ਸੱਤ ਫੇਸ ਜਿਸਨੂੰ ਗੇੜੀ ਰੂਟ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਲੋਕ ਇੱਥੇ ਵੀ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਅਤੇ ਇੱਥੇ ਬਹੁਤ ਪ੍ਰਕਾਰ ਦੀਆਂ ਫਿਲਮਾਂ ਦੇ ਸ਼ੂਕ ਸ਼ੂਟਿੰਗ ਵੀ ਕੀਤੀ ਜਾਂਦੀ ਹੈ